ਸਾਡੇ ਖੇਤਰ ਦੇ ਵਿੱਚ ਬਹੁਤ ਹੀ ਐਸੇ ਕਾਰੋਬਾਰ ਹਨ ਜੋ ਵਧੀਆ ਤਰੀਕੇ ਨਾਲ ਚੱਲ ਸਕਦੇ ਹਨ ਸਾਡੇ ਖੇਤਰ ਵਿੱਚ ਬਹੁਤ ਹੀ ਚੀਜ਼ਾਂ ਦੀ ਡਿਮਾਂਡ ਹੈ ਜਿਵੇਂ ਕਿ ਅੱਜ ਕੱਲ੍ਹ ਇੱਕ ਇੱਥੇ ਨਵਾਂ ਕੰਮ ਚੱਲਿਆ ਹੈ ਤੁਸੀਂ ਕੋਈ ਵੀ ਪ ਪਲੋਟ ਲੈ ਕੇ ਉੱਥੇ ਮਕਾਨ ਦੇ ਵਿੱਚ ਕਮਰੇ ਪਾ ਕੇ ਕਮਰੇ ਕਿਰਾਏ 'ਤੇ ਦੇ ਸਕਦੇ ਹੋ ਜਿਹਦੇ ਨਾਲ ਬਹੁਤ ਹੀ ਅੱਛੀ ਆਮਦਨ ਹੁੰਦੀ ਹੈ ਅੱਜ ਕੱਲ੍ਹ ਕਈ ਦੋਸਤਾਂ ਨੇ ਰਲ ਕੇ ਇੱਕ ਨਵਾਂ ਕੰਮ ਸ਼ੁਰੂ ਕੀਤਾ ਹੈ ਇੱਕ ਵੱਡਾ ਪਲਾਟ ਲੈ ਕੇ ਉਹਦੇ ਵਿੱਚ ਇੱਕ ਔਰਗੈਨਿਕ ਖੇਤੀ ਦਾ ਕੰਮ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਤੁਹਾਨੂੰ ਜਿਸ ਤਰ੍ਹਾਂ ਪਤਾ ਹੈ ਕਿ ਅੱਜ ਕੱਲ੍ਹ ਹਰ ਚੀਜ਼ ਦੇ ਵਿੱਚ ਮਿਲਾਵਟ ਹੈ ਹਰ ਬੰਦੇ ਦੀ ਹਰ ਇੱਕ ਚੀਜ਼ ਮਿਲਾਵਟ ਕਰਕੇ ਬੰਦੇ ਦੀ ਸਿਹਤ 'ਤੇ ਬਹੁਤ ਪ੍ਰਭਾਵ ਪਾ ਰਹੀ ਹੈ ਇਸ ਲੀਏ ਹਰ ਇੱਕ ਚੰਗਾ ਫੈਮਿਲੀ ਵਾਲਾ ਇਹ ਚਾਹੁੰਦਾ ਹੈ ਕਿ ਔਰਗੈਨਿਕ ਸਬਜ਼ੀ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਸਾਡੇ ਸਰੀਰ ਨੂੰ ਹੋਣ ਵਾਲਾ ਨੁਕਸਾਨ ਬਹੁਤ ਘੱਟ ਹੋ ਜਾਵੇ ਇਸ ਤੋਂ ਇਲਾਵਾ ਅੱਜ ਕੱਲ੍ਹ ਸਾਡੇ ਖੇਤਰ ਦੇ ਵਿੱਚ ਖਾਣ ਪੀਣ ਦਾ ਕੰਮ ਬਹੁਤ ਜ਼ਿਆਦਾ ਤੇਜ਼ ਤੇਜ਼ੀ ਨਾਲ ਖੁੱਲ ਰਿਹਾ ਹੈ ਅੱਜ ਕੱਲ੍ਹ ਇੱਥੇ ਚਾਏ ਵਾਲੇ ਦੇ ਕ ਚਾਹ ਦੇ ਕੰਮ ਬਹੁਤ ਤੇਜ਼ੀ ਨਾਲ ਖੁੱਲ ਰਹੇ ਹਨ ਜਿਹਦੇ ਵਿੱਚ ਬਹੁਤ ਹੀ ਤਰ੍ਹਾਂ ਤਰ੍ਹਾਂ ਦੇ ਫਲੇਵਰ ਕਸਟਮਰ ਨੂੰ ਦਿੱਤੇ ਜਾਂਦੇ ਹਨ ਵੀ ਜਿਹਦੇ ਕਸਟਮਰ ਬਹੁਤ ਲੁਭਾਵਿਤ ਹੁੰਦੇ ਹਨ ਇਸ ਤੋਂ ਇਲਾਵਾ ਅੱਜ ਕੱਲ੍ਹ ਦੇ ਕੰਮ ਦੇ ਵਿੱਚ ਪ੍ਰੋਪਰਟੀ ਦਾ ਕੰਮ ਬਹੁਤ ਰਾਈਜ ਕਰ ਰਿਹਾ ਹੈ ਪ੍ਰੋਪਰਟੀ ਦੇ ਵਿੱਚ ਲੋਕ ਬਹੁਤ ਜ਼ਿਆਦਾ ਇਨਵੈਸਟ ਕਰ ਰਹੇ ਹਨ ਪਰ ਲੋਕੀ ਅੱਜ ਕੱਲ੍ਹ ਸ਼ੇਅਰ ਮਾਰਕੀਟ ਵਾਲੇ ਪਾਸੇ ਵੀ ਬਹੁਤ ਜ਼ਿਆਦਾ ਜਾ ਰਹੇ ਹਨ ਜਿਸ ਦੇ ਵਿੱਚ ਰਿਟਰਨ ਬਹੁਤ ਅੱਛੀ ਆ ਰਹੀ ਹੈ ਕਈ ਲੋਕੀ ਅੱਜ ਕੱਲ੍ਹ ਪੈਸੇ ਨੂੰ ਇਨਵੈਸਟ ਕਰਨ ਲਈ ਮਿਊਚੁਅਲ ਫੰਡ ਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਹਨ ਮਿਊਚਲ ਫੰਡ ਦੇ ਵਿੱਚ ਇੱਕ ਖਾਸੀਅਤ ਇਹ ਹੈ ਕਿ ਤੁਹਾਨੂੰ ਇਹਦੇ ਵਿੱਚ ਜਲਦੀ ਕਿਤੇ ਨੁਕਸਾਨ ਬਹੁਤ ਘੱਟ ਹੁੰਦਾ ਹੈ ਇਸ ਦਾ ਤੁਹਾਨੂੰ ਆਉਣ ਵਾਲੇ ਟਾਈਮ ਵਿੱਚ ਫਾਇਦਾ ਹੀ ਫਾਇਦਾ ਹੁੰਦਾ ਹੈ ਅੱਜ ਕੱਲ੍ਹ ਕਈ ਪਰਸਨਸ ਕੱਪੜੇ ਦੀ ਸਪਲਾਈ ਦਾ ਵੀ ਕੰਮ ਬਹੁਤ ਜ਼ਿਆਦਾ ਕਰ ਰਹੇ ਹਨ ਕਈਆਂ ਨੇ ਅੱਜ ਕੱਲ੍ਹ ਇੱਥੇ ਇੱਕ ਢਾਬਾ ਜਿਹਾ ਖੋਲ ਲਿਆ ਹੈ ਜਿਹੜਾ ਕਿ ਹਰ ਮੱਧ ਵਰਗ ਅਤੇ ਅਮੀਰ ਵਰਗ ਲਈ ਜ ਬਹੁਤ ਫਾਇਦੇਦਾਰ ਸਾਬਿਤ ਹੋ ਰਿਹਾ ਹੈ ਮੱਧਵਰਗ ਵੀ ਬੰਦਾ ਉੱਥੇ ਰੇਟ ਬਹੁਤ ਜਾਇਜ਼ ਰੱਖ ਕੇ ਮੱਧ ਵਰਗ ਵਾਲਾ ਬੰਦਾ ਵੀ ਉੱਥੇ ਰੋਟੀ ਖਾਂਦਾ ਹੈ ਅਤੇ ਅਮੀਰ ਵਰਗ ਵਾਲਾ ਬੰਦਾ ਵੀ ਉੱਥੇ ਰੋਟੀ ਖਾਂਦਾ ਹੈ ਇਸ ਤੋਂ ਇਲਾਵਾ ਬਹੁਤ ਹੀ ਇੱਦਾਂ ਦੇ ਛੋਟੇ ਮੋਟੇ ਬਿਜਨਸ ਹਨ ਜਿਹਨਾਂ ਤੋਂ ਲੋਕ ਬਹੁਤ ਜ਼ਿਆਦਾ ਫਾਇਦਾ ਚੁੱਕ ਰਹੇ ਹਨ ਅਤੇ ਜਿਹੜੇ ਬਹੁਤ ਹੀ ਬੈਨੀਫਿਟ ਦੇ ਰਹੇ ਹਨ ਸਾਰੇ ਸਾਰਿਆਂ ਨੂੰ